ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਸਾਰੇ ਸਿੰਗਰ ਆਪਣੇ ਪਹਿਰਾਵੇ ਕਰਕੇ ਵੀ ਜਾਣੇ ਜਾਂਦੇ ਹਨ ਇਹਨਾਂ ਵਿੱਚੋਂ ਇੱਕ ਪੰਜਾਬੀ ਗਾਇਕ ਨਿਮਰਤ ਖਹਿਰਾ ਹੈ ਜਿਸ ਦਾ ਪਹਿਰਾਵਾ ਬਹੁਤ ਹੀ ਵਧੀਆ ਹੈ ਉਸ ਨੇ ਆਪਣੀਆਂ ਫਿਲਮਾਂ ਅਤੇ ਗਾਣਿਆਂ ਵਿੱਚ ਸਦਾ ਪਹਿਰਾਵਾ ਸਾਦਾ ਹੀ ਪਾਇਆ ਹੋਇਆ ਹੈ ਉਸ ਦੀ ਪਹਿਚਾਣ ਪੰਨ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ ਨਿਮਰਤ ਖਹਿਰਾ ਅਕਸਰ ਪੰਜਾਬੀ ਸੂਟਾਂ ਵਿੱਚ ਹੀ ਨਜ਼ਰ ਆਉਂਦੀ ਹੈ ਇੰਨੀ ਪ੍ਰਸਿੱਧ ਅਦਾਕਾਰ ਹੋਣ ਦੇ ਬਾਵਜੂਦ ਵੀ ਉਹ ਸਾਦਗੀ ਨੂੰ ਪਹਿਲ ਦਿੰਦੀ ਹੈ ਮੈਨੂੰ ਉਸ ਦੇ ਸੂਟ ਪਾਉਣ ਦਾ ਢੰਗ ਬਹੁਤ ਵਧੀਆ ਲੱਗਿਆ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਕਾਫੀ ਸਾਰੇ ਸੂਟ ਸਵਾਏ ਅਤੇ ਮੈਨੂੰ ਪੰਜਾਬੀ ਸੂਟ ਪਾਉਣਾ ਵੀ ਬਹੁਤ ਵਧੀਆ ਲੱਗਦਾ ਹੈ ਇਸ ਤੋਂ ਇਲਾਵਾ ਟੋਲੀਵੁੱਡ ਫਿਲਮਾਂ ਵਿੱਚ ਉਹਨਾਂ ਦਾ ਆਮ ਪਹਿਰਾਵਾ ਦੇਖਣ ਨੂੰ ਮਿਲਦਾ ਹੈ ਉਹ ਆਪਣੀ ਹਰ ਫਿਲਮ ਵਿੱਚ ਆਪਣੀ ਸੰਸਕ੍ਰਿਤੀ ਨੂੰ ਪੇਸ਼ ਕਰਦੇ ਹਨ ਮੈਨੂੰ ਉਹਨਾਂ ਦੀ ਸਾੜੀ ਪਹਿਨਣ ਦਾ ਢੰਗ ਵੀ ਬਹੁਤ ਵਧੀਆ ਲੱਗਦਾ ਹੈ ਮੈਂ ਉਸ ਤਰ੍ਹਾਂ ਦੀ ਸਾੜੀ ਪਹਿਨਣਾ ਵੀ ਸਿੱਖਿਆ ਸੀ ਜੋ ਕਿ ਬਹੁਤ ਵਧੀਆ ਲੱਗੀ ਕਿਉਂਕਿ ਟੋਲੀਵਿਡ ਵਿੱਚ ਸਾਰੀਆਂ ਸਾੜੀ ਪਹਿਨਣ ਦਾ ਤਰੀਕਾ ਬਹੁਤ ਹੀ ਵੱਖਰਾ ਹੈ ਕਿਉਂਕਿ ਟੋਲੀਵੁੱਡ ਵਿੱਚ ਹਰ ਸਿਤਾਰਾ ਵੱਖਰੇ ਢੰਗ ਨਾਲ ਸਾੜੀ ਪਹਿਨਦਾ ਹੈ ਮੈਨੂੰ ਵੱਖਰੇ ਵੱਖਰੇ ਢੰਗ ਨਾਲ ਸਾੜੀ ਪਹਿਨਣਾ ਬਹੁਤ ਵਧੀਆ ਲੱਗਦਾ ਹੈ